ਮੇਰੇ ਕੋਲ ਫੋਟੋਆਂ ਦੀ ਪੁਰਾਣੀ ਹਾਰਡ ਕਾਪੀ ਕਲਿਕ ਕੀਤੀ ਹੋਈ ਹੈ ਮੈਂ ਅਪ ਆਪਣੀ ਮੰਮੀ ਦੀ ਪੁਰਾਣੇ ਸਮੇਂ ਉੱਨੀ ਸੌ ਨੱਬੇ ਵੇਲੇ ਦੀ ਖਿੱਚੀਆਂ ਹੋਈਆਂ ਫੋਟੋਆਂ ਦੇਖੀਆਂ ਹਨ ਅਤੇ ਉਸ ਵਿੱਚ ਉਹ ਫੋਟੋਆਂ ਬਹੁਤ ਹੀ ਬਲੈਕ ਐਂਡ ਵਾਈਟ ਹਨ ਉਸ ਵਿੱਚ ਹੁਣ ਤਾਂ ਹੁਣ ਬੜੀਆਂ ਖਿੱਚੀਆਂ ਫੋਟੋਆਂ ਜਿਹੜੀਆਂ ਹਨ ਡਿਜੀਟਲ ਫੋਟੋਸ ਦੇ ਵਿੱਚ ਕਲੈਰਟੀ ਹਨ ਅਤੇ ਜਿਹੜੀਆਂ ਉਹ ਹਾਂ ਪੁਰਾਣੇ ਹਾਰਡ ਕਾਪੀ ਨਾਲ ਕਲਿੱਕ ਕੀਤੀ ਫੋਟੋ ਦੇ ਵਿੱਚ ਉਹ ਬਲੈਕ ਅਤੇ ਵਾਈਟ ਹਨ ਅੱਜ ਕੱਲ੍ਹ ਜਿਹੜੀਆਂ ਫੋਟੋਆਂ ਖਿੱਚੀਆਂ ਜਾਂਦੀਆਂ ਹਨ ਉਹ ਉਹਦੇ ਵਿੱਚ ਪਿਕਸਲ ਕਲੈਰਟੀ ਤਾਂ ਐ ਐਚਡੀ ਫੁੱਲ ਐਚਡੀ ਜਿਵੇਂ ਆ ਕਿ ਆ ਅਸੀਂ ਵੀ ਇਸ ਤਰ੍ਹਾਂ ਹਨ ਜਿਹੜੀਆਂ ਪੁਰਾਣੇ ਸਮੇਂ 'ਚ ਹਾਰਡ ਕਾਪੀ ਨਾਲ ਖਿੱਚੀਆਂ ਫੋਟੋਆਂ ਸੀ ਉਸ ਦੇ ਵਿੱਚ ਇੰਨੀ ਕਲੈਰਟੀ ਨਹੀਂ ਸੀ ਅਤੇ ਨਾ ਹੀ ਐਚਡੀ ਸੀ ਪਰ ਪੁਰਾਣੀਆਂ ਫੋਟੋਆਂ ਵਿੱਚ ਨਾਲੇ ਜ਼ਿਆਦੇ ਇਮੋਸ਼ਨਲੀ ਅਟੈਚ ਹਨ ਲੋਕੀ ਸਪੈਸ਼ਲ ਤਿਆਰ ਹੋ ਕੇ ਖਿੱਚਣ ਜਾਂਦੇ ਸਨ ਫੋਟੋਆਂ ਸਪੈਸ਼ਲੀ ਕੱਪੜੇ ਪਾ ਕੇ ਉਹ ਫੋਟੋਆਂ ਕਿਸੇ ਕੋਲੋਂ ਖਿਚਾਉਣ ਜਾਂਦੇ ਸਨ ਪਰ ਅੱਜ ਕੱਲ੍ਹ ਹਰੇਕ ਕੋਲ ਆਪਣਾ ਆਪਣਾ ਮੋਬਾਈਲ ਹੈ ਉਹ ਆਪੇ ਫੋਟੋ ਖਿੱਚ ਲੈਂਦੇ ਹਨ ਅਤੇ ਉਸ ਵਿੱਚ ਕਈ ਤਰ੍ਹਾਂ ਦੇ ਫਿਲਟਰ ਹਨ ਅਤੇ ਉਸ ਲਈ ਉਹ ਫਿਲਟਰਾਂ ਦੇ ਵਿੱਚ ਆਪਣੇ ਆਪ ਹੀ ਉਹ ਤਿਆਰ ਹੋ ਜਾਂਦੇ ਉਹਦੇ ਲਈ ਉਹ ਸਪੈਸ਼ਲੀ ਤਿਆਰ ਨਹੀਂ ਹੁੰਦੇ ਅਤੇ ਅੱਜ ਵਾਲੇ ਫੋਟੋਆਂ ਦੇ ਵਿੱਚ ਬਹੁਤ ਹੀ ਟਾਈਪ ਦੀ ਕਲੈਰਟੀ ਹੈ ਬਹੁਤ ਸਾਰੇ ਫਿਲਟਰ ਹਨ ਅਤੇ ਅੱਜ ਨਵੀਆਂ ਫੋਟੋਆਂ ਜਿਹੜੀਆਂ ਹਨ ਉਹ ਪਹਿਲਾਂ ਵਾਲੀਆਂ ਫੋਟੋਆਂ ਨਾਲੋਂ ਥੋੜ੍ਹੀ ਕਲੈਰਟੀ ਨਾਲ ਜ਼ਿਆਦਾ ਹਨ ਪਰ ਪੁਰਾਣੀਆਂ ਫੋਟੋਆਂ ਜਿਹੜੀਆਂ ਖਿੱਚੀਆਂ ਹਨ ਬਲੈਕ ਐਂਡ ਵਾਈਟ ਉਸ ਦੇ ਨਾਲ ਮੈਂ ਜ਼ਿਆਦਾ ਵਧੇਰੇ ਭਾਵਨਾਤਮਕ ਹਾਂ ਅਟੈਚ ਹਾਂ ਉਹ ਬਹੁਤ ਹੀ ਇਮੋਸ਼ਨਲੀ ਨਾਲ ਜੁੜੀ ਹੋਈ ਹਾਂ ਉਹਨਾਂ ਫੋਟੋਆਂ ਨਾਲ ਮੈਂ ਅੱਜ ਵਾਲੀਆਂ ਫੋਟੋਆਂ ਨਾਲ ਕੋਈ ਹਰੇਕ ਆਪਦੀ ਕੱਲੀ ਕੱਲੀ ਖਿ ਫੋਟੋਆਂ ਖਿੱਚਦਾ ਰਹਿੰਦਾ ਹੈ ਪਰ ਜਿਹੜੀਆਂ ਪੁਰਾਣੀਆਂ ਫੋਟੋਆਂ ਹਨ ਉਹ ਇਸ ਲਈ ਪੁਰਾਣੀਆਂ ਫੋਟੋਆਂ ਅਤੇ ਨਵੀਆਂ ਫੋਟੋਆਂ ਦੋਨੋ ਹੀ ਸੇਮ ਹਨ ਬਸ ਉਸ ਦੇ ਵਿੱਚ ਕਲੈਰਟੀ ਥੋੜ੍ਹੀ ਘੱਟ ਹੈ ਪੁਰਾਣੀਆਂ ਫੋ ਹਾਰਡ ਕਾਪੀ ਨਾਲ ਕਲਿੱਕ ਕੀਤੀਆਂ ਫੋਟੋਆਂ ਵਿੱਚ ਪਰ ਜਿਹੜੀਆਂ ਨਵੀਆਂ ਡਿਜੀਟਲ ਫੋਟੋਆਂ ਹਨ ਇਹ ਬਹੁਤ ਹੀ ਵਧੀਆ ਇਹਦੇ 'ਚ ਕਲਰ ਵੀ ਹੈ ਰੰਗੀਨ ਹਨ ਇਹ ਪੁਰਾਣੀਆਂ ਫੋਟੋਆਂ ਬਲੈਕ ਐਂਡ ਵਾਈਟ ਹਨ ਉਸ ਦੇ ਵਿੱਚ ਇੰਨੀ ਪਿਕਸਲ ਵੀ ਪਾ ਪਾੜੇ ਪਾਟੇ ਹੋਏ ਹਨ ਪੁਰਾਣੀ ਹਾਰਡ ਕਾਪੀ ਪਰ ਜਿਹੜੀਆਂ ਅੱਜ ਵਾਲੀਆਂ ਫੋਟੋਆਂ ਖਿੱਚੀਆਂ ਹਨ ਉਹ ਪੂਰੀ ਫੁੱਲ ਕਲੈਰਟੀ ਫੁੱਲ ਐਚਡੀ ਪਿਕਸਲ ਵੀ ਪੂਰਾ ਕੰਪਲੀਟ ਇਸ ਲਈ ਹੈ ਦੋਵੇਂ ਇੱਕੋ ਹੀ ਹਨ ਪੁਰਾਣੀਆਂ ਫੋ ਫੋਟੋਆਂ ਅਤੇ ਅੱਜ ਵਾਲੀਆਂ ਡਿਜੀਟਲ ਫੋ ਫੋਟੋ ਕਾਪੀਆਂ ਦੇ ਵਿੱਚ ਥੋੜ੍ਹਾ ਤਾਂ ਅੰਤਰ ਹੈ ਪਰ ਇਸ ਲਈ ਅੱਜ ਵਾਲੀਆਂ ਨਵੀਆਂ ਡਿਜੀਟਲ ਫੋਟੋਆਂ ਲਈ ਲੋਕੀ ਆਪੋ ਆਪਣੇ ਮੋਬਾਈਲ ਦੇ ਵਿੱਚ ਖਿੱਚ ਲੈਂਦੇ ਹਨ ਇਹਦੇ ਲਈ ਸਪੈਸ਼ਲ ਕੋਈ ਤਿਆ ਤਿਆਰ ਨਹੀਂ ਹੁੰਦੇ ਸਪੈਸ਼ਲ ਕੋਈ ਫੀਚਰ ਨਹੀਂ ਹਨ ਅਤੇ ਪੁਰਾਣੀਆਂ ਫੋਟੋਆਂ ਲਈ ਲੋਕੀ ਸਪੈਸ਼ਲ ਹੀ ਖਿਚਵਾਉਣ ਜਾਂਦੇ ਸਨ ਕਿਸੇ ਹੀ ਸਪੈਸ਼ਲ ਖਾਸ ਸਬੰਧੀ ਤੋਂ ਜੋ ਉਸ ਵਿੱਚ ਨਿਪੁੰਨ ਹੋਵੇ ਇਸ ਲਈ ਅੱਜ ਵਾਲੀਆਂ ਨ ਪੁਰਾਣੀਆਂ ਫੋਟੋਆਂ ਲਈ ਮੈਂ ਬਹੁਤ ਹੀ ਵਧੇਰੇ ਭਾਵਨਾਤਮਕ ਹਾਂ ਅਤੇ ਅੱਜ ਵਾਲੀਆਂ ਨਵੀਆਂ ਡਿਜੀਟਲ ਫੋਟੋਆਂ ਅਤੇ ਪੁਰਾਣੀਆਂ ਡਿਜੀਟਲ ਫੋਟੋਆਂ ਦੋਵਾਂ ਵਿੱਚ ਕੋਈ ਖਾਸਾ ਅੰਤਰ ਨਹੀਂ ਹੈ ਅਤੇ ਪੁਰਾਣੀਆਂ ਫੋਟੋਆਂ ਜਿਹੜੀਆਂ ਵਧੇਰੇ ਭਾਵਨਾਤਮਕ ਹਨ